ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਭਾਅ ਜੀ ਹਾਂਜੀ ਹਾਂਜੀ ਕਿਹਦੇ ਤੋਂ ਹਾਂਜੀ ਹਾਂਜੀ ਹਾਂਜੀ ਭਾਅ ਜੀ ਕਿਹਨੇ ਨੰਬਰ ਦਿੱਤਾ ਕਿੱਥੇ ਜਾਣਾ ਭਾਅ ਜੀ ਤੁਸੀਂ ਪਹਿਲਾਂ ਇਹ ਤਾਂ ਦੱਸੋ ਅੱਛਾ ਥਾਈਲੈਂਡ ਜਾਣਾ ਭਾਅ ਜੀ ਇਹ ਠੀਕ ਮੈਂ ਭਾਅ ਜੀ ਥਾਈਲੈਂਡ ਦਾ ਤੁਹਾਨੂੰ ਗਰੁੱਪ ਜਾਣਾ ਜਾਂ ਤੁਸੀਂ ਸੋਲੋ ਜਾਣਾ ਚਾਹੁੰਦੇ ਹੈ ਸੋਲੋ ਠੀਕ ਹੈ ਠੀਕ ਹੈ ਇਕੱਲੇ ਜਾਣਾ ਤੁਸੀਂ ਤਾਂ ਭਾਅ ਜੀ ਇਹ ਦੇਖੋ ਏ ਉਹ ਤਾਂ ਤੁਹਾਡੀ ਐਕਟੀਵੀਟੀਆਂ ਪਰ ਡਿਪੈਂਡ ਕਰਦਾ ਤੁਸੀਂ ਕਿਆ ਕਿਆ ਐਡ ਕਰਵਾਉਣਾ ਚਾਹੁੰਦੇ ਜੇ ਤੁਸੀਂ ਇਕੱਲਾ ਬੈਂਕਕੋਕ ਜਾਣਾ ਚਾਹੁੰਦੇ ਆ ਤਾਂ ਉਹਦਾ ਪ੍ਰਾਈਜ ਅਲੱਗ ਹੈ ਜੇ ਤੁਸੀਂ ਬੈਂਕਕੋਕ ਪਟਾਇਆ ਕਰਾਬੀ ਇਹ ਤਿੰਨੇ ਜਗ੍ਹਾ ਘੁੰਮਣਾ ਚਾਹੁੰਦੇ ਆ ਤਾਂ ਉਹਦਾ ਅਲੱਗ ਹੈ ਕਿਉਂਕਿ ਬੈਂਕਕੋਕ ਸਿਰਫ ਹੈਗੀ ਕਲੱਬ ਲਾਈ ਨਾਈਟ ਲਾਈਫ ਹੈ ਉੱਥੇ ਜਿੱਦਾਂ ਸ਼ਹਿਰੀ ਇਲਾਕਾ ਜਿੱਦਾਂ ਹੋ ਗਿਆ ਬੀਚ ਲਾਈਫ ਜਿੱਦਾਂ ਗੋਆ ਵਾਲੀ ਲਾਈਫ ਹੈ ਉਹ ਹੈਗੀ ਪਟਾਇਆ 'ਚ ਅਤੇ ਕਰਾਬੀ ਕਰਾਬੀ ਵਾਲੀ ਕਰਾਬੀ 'ਚ ਜੀ ਉੱਥੇ ਟਾਪੂਆਂ ਦੀ ਲਾਈ ਜਿਹੜੀ ਘੁੰਮਣ ਫਿਰਨ ਵਾਲੀ ਦੇਖੋ ਤੁਹਾਨੂੰ ਬੈਂ ਬੈਂਕਕੋਕ 'ਚ ਅਸੀਂ ਤੁਹਾਨੂੰ ਟਾਈਗਰ ਪਾਰਕ ਘੁਮਾ ਦੇਵਾਂਗੇ ਮਿਊਜੀਅਮ ਪਾਰਕ ਉੱਥੇ ਤੁਹਾਨੂੰ ਰਾਤ ਨੂੰ ਕਲੱਬਾਂ 'ਚ ਘੁਮਾ ਦੇਵਾਂਗੇ ਸੁਈ ਦੁਈ ਲੇਕ ਘੁੰਮਾ ਦੇਵਾਂਗੇ ਠੀਕ ਆ ਉੱਥੇ ਕੋਆਏਬੁਆਏ ਸਟਰੀਟ ਘੁੰਮਾ ਦੇਵਾਂਗੇ ਠੀਕ ਹੈ ਜੀ ਅਤੇ ਤੁਹਾਨੂੰ ਜੇ ਤੁਸੀਂ ਜੇ ਤੁਸੀਂ ਪਟਾਇਆ ਵੀ ਜਾਣਾ ਤਾਂ ਤੁਹਾਨੂੰ ਪਟਾਇਆ ਵਾਕਿੰਗ ਸਟਰੀਟ ਘੁਮਾ ਦੇਵਾਂਗੇ ਤੁਹਾਨੂੰ ਪਟਾਇਆ ਕੋਰਲ ਆਈਲੈਂਡ ਘੁਮਾ ਦੇਵਾਂਗੇ ਪਟਾਇਆ ਤੁਹਾਨੂੰ ਵਧੀਆ ਫਾਈਵ ਸਟਾਰ ਹੋਟਲ 'ਚ ਤੁਹਾਡੀ ਬੁਕਿੰਗਾਂ ਕਰਵਾ ਦੇਵਾਂਗੇ ਜੇ ਤੁਸੀਂ ਕਰਾਬੀ ਵੀ ਘੁੰਮਣਾ ਤਾਂ ਤੁਹਾਨੂੰ ਕਰਾਬੀ ਵੀ ਕਰਵਾ ਦੇਵਾਂਗੇ ਕਰਾਬੀ ਵੀ ਸਾਡੇ ਹੈਗੇ ਉੱਧਰ ਸਾਰੇ ਤੁਸੀਂ ਐਂ ਦ ਤੁਸੀਂ ਜਿੰਨੀਆਂ ਚ ਜੋ ਜੋ ਤੁਸੀਂ ਕਿਤੇ ਐਕਟੀਵਿਟੀ ਵੀ ਹੁੰਦੀਆਂ ਹੁੰਦੀਆਂ ਪਟਾਇਆ 'ਚ ਜਿਦਾਂ ਬੋ ਜੈਟਸਕੀ ਬੋਟਸ ਪੈਰਾਂਸਲਿੰਗ ਪੈਰਾਗਲਾਈਡਿੰਗ ਸਭ ਉੱਥੇ ਹੁੰਦਾ ਜੋ ਜੋ ਤੁਸੀਂ ਐਡ ਕਰਵਾਉਗੇ ਉਸ ਹਿਸਾਬ ਨਾਲ ਤੁਹਾਨੂੰ ਰੇਟ ਹਾਈ ਹੋਈ ਜਾਣਾ ਉੱਦਾਂ ਨੋਰਮਲ ਸਾਡਾ ਦੋ ਦੋ ਮਤਲਬ ਸਾਡਾ ਜਿਹੜਾ ਨੋਰਮਲ ਹੈ ਨਾ ਜਿੱਦਾਂ ਪਟਾਇਆ ਅਤੇ ਬੈਂਕਕੋਕ ਦੋਨੇ ਜਣਾ ਜੇ ਜਾਣਾ ਦੋ ਜਗ੍ਹਾ ਜਾਣਾ ਉਹਦੇ ਵਿੱਚ ਥੋੜ੍ਹੀਆਂ ਅ ਆਈਲੈਡ ਵੀ ਘੁਮਾਉਣੇ ਜੇ ਐਕਟੀਵੇਟੀ ਵੀ ਐਡ ਕਰਾਂਗੇ ਤਾਂ ਇੱਕ ਲੱਖ ਰੁਪਏ ਸਾਡਾ ਇੱਕ ਬੰਦੇ ਦਾ ਪਰ ਚਾਰਜ ਹੈਗਾ ਇਹ ਤੁਸੀਂ ਬੀਚ ਭਾਅ ਜੀ ਯਾਰ ਜੇ ਤੁਸੀਂ ਬੀਚ ਦੇ ਤੁਹਾਨੂੰ ਐਨ ਕੰਢੇ 'ਤੇ ਫਾਈਵ ਸਟਾਰ ਹੋਟਲ ਦੇ ਦੇਣਾ ਤੁਹਾਨੂੰ ਬੀਚ ਵਿਊ ਮਿਲੇਗਾ ਤੁਹਾਨੂੰ ਬੈਂਕਕੋਕ ਤਿੰਨ ਚਾਰ ਦਿਨ ਦੀ ਸਟੇ ਚਾਰ ਦਿਨ ਦੀ ਸਟੇ ਤੁਹਾਨੂੰ ਦੇ ਦੇਣੀ ਹੈ ਅਸੀਂ ਪਟਾਇਆ 'ਚ ਅਤੇ ਤੁਹਾਨੂੰ ਅ ਤੁਹਾਨੂੰ ਇੱਥੇ ਤੁਹਾਨੂੰ ਟਿਕਟ ਕਰਵਾ ਕੇ ਦੇਵਾਂਗੇ ਉੱਥੋਂ ਤੋਂ ਆਉਣ ਜਾਣ ਅਪ ਡਾਊਨ ਤੁਹਾਨੂੰ ਟੈਕਸੀ ਆਪੇ ਲੈ ਕੇ ਜਾਊਗੀ ਤੁਹਾਨੂੰ ਹੋਟਲ ਤੱਕ ਵੀ ਉਤਾਰੇਗੀ ਤੁਹਾਨੂੰ ਟੂਰ ਤੁਹਾਨੂੰ ਗਾਈਡ ਵੀ ਦਊਂਗੇ ਜਿਹੜਾ ਤੁਹਾਨੂੰ ਨਾਲ ਲੈ ਕੇ ਜਾਊਂਗਾ ਜਿਹੜਾ ਤੁਹਾਨੂੰ ਹਰੇਕ ਜਗ੍ਹਾ ਘੁਮਾਉਗਾ ਤੁਹਾਡੇ ਐਕਟੀਵਿਟੀਆਂ ਦਾ ਵੀ ਜਿਹਨੇ ਸਾਰਾ ਵੇਖਣਾ ਹੈ ਜਿਹਨੇ ਤੁਹਾਨੂੰ ਸਾਰਾ ਏ ਟੂ ਜ਼ੈਡ ਤੁਹਾਨੂੰ ਜਿਹਨੇ ਤੁਹਾਨੂੰ ਘੁਮਾਉਣਾ ਉਹ ਬੰਦਾ ਵੀ ਤੁਹਾਡੇ ਕੋਲ ਆਊਗਾ ਤੁਹਾਨੂੰ ਹੋਟਲ ਵੀ ਤੁਹਾਨੂੰ ਵਧੀਆ ਦੇ ਕੇ ਦੇਵਾਂਗੇ ਜੇ ਤੁਸੀਂ ਕੁਝ ਵੀ ਐਡ ਜਾਂ ਕੁਝ ਵੀ ਕਰਵਾਉਣਾ ਚਾਹੁੰਦੇ ਜੇ ਤੁਸੀਂ ਘਟਾਉਣਾ ਵਧਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਹੁਣ ਦੱਸ ਸਕਦੇ ਹੈ ਜੋ ਵੀ ਤੁਹਾਨੂੰ ਜਿੱਦਾਂ ਜਿੱਦਾਂ ਤੁਹਾਨੂੰ ਲੱਗੇ ਡੇ ਟਾਈਮ ਜਿੱਦਾਂ ਦਾ ਲੱਗੇ ਜੋ ਤੁਹਾਨੂੰ ਜਿੱਦਾਂ ਹੋਟਲ ਵੀ ਜੇ ਤੁਹਾਨੂੰ ਨਹੀਂ ਪਸੰਦ ਹੈਗਾ ਤੁਸੀਂ ਫਾਈਵ ਸਟਾਰ ਨਹੀਂ ਲੈਣਾ ਜਾਂ ਥੋੜ੍ਹਾ ਬਜਟ ਘੱਟ ਹੈ ਥ੍ਰੀ ਸਟਾਰ ਲੈਣਾ ਉਹ ਵੀ ਤੁਸੀਂ ਦੇਖ ਸਕਦੇ ਹੈ

ਠੀਕ ਹੈ ਭਾਅ ਜੀ ਮੈਨੂੰ ਫਿਰ ਦੱਸ ਦਿਓ ਇਹੀ ਨੰਬਰ ਹੈ ਭਾਅ ਜੀ ਓਕੇ ਭਾਅ ਜੀ ਓਕੇ ਸਤਿ ਸ਼੍ਰੀ